ਸਭ ਤੋਂ ਪਹਿਲੀ ਚੁਣੌਤੀ ਜਿਹੜੀ ਮੇਰੇ ਦਿਮਾਗ 'ਚ ਆਉਂਦੀ ਹੈ ਉਹ ਹੈ ਟ੍ਰੈਫਿਕ ਤਾਂ ਟ੍ਰੈਫਿਕ ਦੋ ਤਰੀਕਿਆਂ ਨਾਲ ਮੈਨੂੰ ਲੱਗਦਾ ਮੇਜਰ ਹੁੰਦਾ ਇੱਕ ਤਾਂ ਜਦੋਂ ਧਰਨੇ ਲੱਗਦੇ ਨੇ ਤਾਂ ਕੁਛ ਰੋਡਵੇਜ਼ ਬਲੋਕ ਕਰ ਦਿੱਤੇ ਜਾਂਦੇ ਨੇ ਜਿਵੇਂ ਮੈਂ ਆਪਣੇ ਘਰ ਤੋਂ ਕੋਲੇਜ ਜਾਂਦੀ ਹਾਂ ਤਾਂ ਰਸਤੇ ਵਿੱਚ ਇੱਕ ਬਿਜਲੀ ਬੋਰਡ ਦਾ ਦਫ਼ਤਰ ਆਉਂਦਾ ਜਿੱਥੇ ਅਕਸਰ ਧਰਨਾ ਲੱਗਾ ਹੀ ਹੁੰਦਾ ਆ ਹਰ ਹਫ਼ਤੇ ਦੋ ਹਫ਼ਤੇ ਬਾਅਦ ਤਾਂ ਫਿਰ ਉਸ ਤੋਂ ਬਾਅਦ ਰੂਟ ਬਦਲ ਕੇ ਰੋਜ਼ ਕੋਲੇਜ ਜਾਣਾ ਪੈਂਦਾ ਉਸ ਤੋਂ ਇਲਾਵਾ ਕੋਲੇਜ ਵਾਪਸੀ ਆਉਣ ਵੇਲੇ ਮੈਂ ਬਹੁਤ ਵਾਰ ਦੇਖਿਆ ਕਿ ਕਦੇ ਕਿਸੇ ਮੰਤਰੀ ਨੇ ਜਾਂ ਕਿਸੇ ਪੋਲੀਟੀਕਲ ਪਾਰਟੀ ਨੇ ਰਸਤੇ 'ਚੋਂ ਲੰਘਣਾ ਹੋਵੇ ਤਾਂ ਘੱਟੋ ਘੱਟ ਮੈਨੂੰ ਲੱਗਦਾ ਪੰਦਰਾਂ ਵੀਹ ਮਿੰਟ ਪਹਿਲਾਂ ਹੀ ਉਹ ਰੋਡ ਜਿਹੜੀ ਆ ਬਲੋਕ ਕਰ ਦਿੰਦੇ ਨੇ ਜਾਂ ਲੋਕਾਂ ਨੂੰ ਰੋਕ ਦਿੰਦੇ ਨੇ ਉੱਥੋਂ ਆਉਣ ਲਈ ਤਾਂ ਮੈਨੂੰ ਲੱਗਦਾ ਵੀ ਜੇ ਉਹਨਾਂ ਨੂੰ ਸਪੈਸ਼ਲ ਟਰੀਟਮੈਂਟ ਦਿੱਤਾ ਜਾ ਰਿਹਾ ਚਲੋ ਜੇ ਦੇ ਵੀ ਰਹੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜਿਹੜੇ ਵੀ ਟ੍ਰੈਫਿਕ ਸਰਵਿਸਮੈਨ ਨੇ ਜਾਂ ਪੁਲਿਸ ਵਾਲੇ ਨੇ ਕਿ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹ ਟ੍ਰੈਫਿਕ ਨੂੰ ਕੰਟਰੋਲ ਕਰਨ ਤੇ ਅਵਲਦਲ ਤਾਂ ਮੈਨੂੰ ਲੱਗਦਾ ਵੀ ਕਿਸੇ ਨੂੰ ਵੀ ਸਪੈਸ਼ਲ ਟ੍ਰੀਟਮੈਂਟ ਨਹੀਂ ਦੇਣਾ ਚਾਹੀਦਾ ਬਾਕੀ ਮੈਨੂੰ ਨਹੀਂ ਲੱਗਦਾ ਵੀ ਮੈਂ ਆਪਣੀ ਨੌਲੇਜ ਦੇ ਹਿਸਾਬ ਸਿਰ ਸਹੀ ਆ ਜਾਂ ਗਲਤ ਹੈ ਇਸ ਗੱਲ 'ਤੇ ਤਾਂ ਬਸ ਮੈਂ ਆਪਣੀ ਦਿੱਕਤ ਜਾ ਜ਼ਾਹਿਰ ਕਰ ਰਹੀ ਹਾਂ ਵੀ ਕੀ ਦਿੱਕਤ ਹੈ ਉਸ ਤੋਂ ਇਲਾਵਾ ਚੁਣੌਤੀਆਂ ਦੀ ਗੱਲ ਕੀਤੀ ਜਾਵੇ ਤਾਂ ਕੈਟਗਰਾਜੇਜ਼ਨ ਨਹੀਂ ਹੋਣੀ ਚਾਹੀਦੀ ਮਤਲਬ ਕਿ ਲੋਕਾਂ ਨੂੰ ਕੈਟਗਰੀਜ਼ ਵਿੱਚ ਵੰਡਣਾ ਕਿ ਇਹ ਜਨਰਲ ਹੈ ਐਸ ਈ ਇਹ ਬੀ ਸੀ ਹੈ ਅਤੇ ਇਹ ਓ ਬੀ ਸੀ ਹੈ ਕਿਉਂਕਿ ਮੈਨੂੰ ਲੱਗਦਾ ਹੈ ਵੀ ਜੇ ਕੈਟਗਰਾਈਜੇਸ਼ਨ ਹੁੰਦੀ ਹੈ ਫਿਰ ਜਿਹੜੇ ਲੋਅਰ ਕਾਸਟ ਦੇ ਹੁੰਦੇ ਨੇ ਉਹਨਾਂ ਨੂੰ ਫਸਿਲੀਟੀਜ਼ ਜ਼ਿਆਦਾ ਮਿਲ ਜਾਂਦੀਆਂ ਨੇ ਉਹਨਾਂ ਵਾਸਤੇ ਰਿਜਰਵੇਸ਼ਨਸ ਵੀ ਹੁੰਦੀਆਂ ਨੇ ਅਤੇ ਹਾਈਅਰ ਕਾਸਟ ਜਾਂ ਰਿਚ ਲੋਕਾਂ ਨੂੰ ਤਾਂ ਲੋੜ ਹੀ ਨਹੀਂ ਪੈਂਦੀ ਕਿਸੇ ਵੀ ਫਸਿਲਿਟੀ ਦੀ ਕਿਉਂਕਿ ਉਹਨਾਂ ਕੋਲ ਪੈਸਾ ਹੁੰਦਾ ਉਹਨਾਂ ਕੋਲ ਪਾਵਰ ਹੁੰਦੀ ਹੈ ਪਰ ਜਿਹੜੇ ਮਿਡਲ ਲੈਵਲ ਵਾਲੇ ਹੁੰਦੇ ਨੇ ਮਿਡਲ ਕਾਸਟ ਜਾਂ ਜਨਰਲ ਕੈਟਾਗਰੀਜ਼ ਦੇ ਬੰਦੇ ਹੁੰਦੇ ਨੇ ਉਹ ਇਸ ਜੱਦੋ ਜਹਿਦ ਵਿੱਚ ਫਸ ਜਾਂਦੇ ਨੇ ਕਿਉਂਕਿ ਉਹ ਉਹ ਬਿਲੋਅ ਲਾਈਨ ਨਹੀਂ ਆਉਂਦੇ ਤਾਂ ਉਹ ਫਸਲਿਟੀਜ਼ ਦਾ ਜਿਹੜਾ ਫਾਈਦਾ ਨਹੀਂ ਉੱਠਾ ਸਕਦੇ ਕਹਿ ਲਉ ਵੀ ਕੋਈ ਫ੍ਰੀ ਕਣਕ ਦੀ ਗੱਲ ਹੋਵੇ ਜਾਂ ਹੋਰ ਕੋਈ ਗੱਲ ਹੋਵੇ ਜਾਂ ਕੋਈ ਵੀ ਫਸਿਲਿਟੀ ਹੋਵੇ ਜਿਹੜੀ ਸਿਰਫ਼ ਲੋਅਰ ਕਾਸਟ ਦੇ ਬੰਦਿਆਂ ਨੂੰ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਇਲਾਵਾ ਮੈਨੂੰ ਲੱਗਦਾ ਵੀ ਕੈਟਾਗਰੀਜ਼ੇਸ਼ਨ ਹੋਣੀ ਹੀ ਨਹੀਂ ਚਾਹੀਦੀ ਕਿਸੇ ਨੂੰ ਵੀ ਕਿਸੇ ਵੀ ਤਰੀਕੇ ਦੀ ਕੋਈ ਵੀ ਫਸਿਲਿਟੀ ਨਹੀਂ ਦਿੱਤੀ ਜਾਣੀ ਚਾਹੀਦੀ ਤਾਂ ਕਿ ਹਰ ਕਿਸੇ ਨੂੰ ਪਤਾ ਲੱਗੇ ਵੀ ਅਸੀਂ ਕਿਸ ਤਰੀਕੇ ਨਾਲ ਮਿਹਨਤ ਕਰਕੇ ਹਰ ਚੀਜ਼ ਕਮਾਉਣੀ ਹੈ ਚਾਹੇ ਉਹ ਕੋਈ ਕੋਟਾ ਦੇ ਜਾਂ ਕੋਟੇ ਦੇ ਅਧਾਰਿਤ ਕੋਈ ਸੀਟ ਹੋਵੇ ਕੋਈ ਨੌਕਰੀ ਹੋਵੇ ਜਾਂ ਫਿਰ ਜਿਹੜੀਆਂ ਫਸਿਲਿਟੀਜ਼ ਨੇ ਉਹ ਸਭ ਦੇ ਲਈ ਹੋਣੀਆਂ ਚਾਹੀਦੀਆਂ ਨੇ ਕਿਸੇ ਇੱਕ ਦੇ ਲਈ ਇਹ ਨਹੀਂ ਹੋਣੀਆਂ ਚਾਹੀਦੀਆਂ ਕਿਸੇ ਇੱਕ ਜਾਤੀ ਪ੍ਰਜਾਤੀ ਲਈ ਨਹੀਂ ਹੋਣੀਆਂ ਚਾਹੀਦੀਆਂ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਪਾਣੀ ਦਾ ਜਿਹੜਾ ਬਿੱਲ ਹੈ ਉਹ ਜ਼ਰੂਰ ਆਉਣਾ ਚਾਹੀਦਾ ਹੈ ਪਾਣੀ ਦਾ ਬਿੱਲ ਆਉਣਾ ਜ਼ਰੂਰੀ ਇਸ ਲਈ ਹੈ ਕਿਉਂਕਿ ਪਾਣੀ ਜਿਹੜਾ ਹੈ ਬਹੁਤ ਕੀਮਤੀ ਰਿਸੋਰਸ ਹੈ ਤਾਂ ਮੈਨੂੰ ਲੱਗਦਾ ਸਾਡੇ ਪੰਜਾਬ ਦੇ ਲੋਕ ਸਭ ਤੋਂ ਜ਼ਿਆਦਾ ਪਾਣੀ ਵੇਸਟ ਕਰਨ ਵਿੱਚ ਅੱਗੇ ਨੇ ਫਿਰ ਚਾਹੇ ਉਹ ਪਾਈਪਾਂ ਲਾ ਕੇ ਗੱਡੀਆਂ ਧੋਣੀਆਂ ਹੋਣ ਜਾਂ ਹੋਰ ਕੋਈ ਚੀਜ਼ ਹੋਵੇ ਤਾਂ ਮੈਨੂੰ ਲੱਗਦਾ ਜੇ ਪਾਣੀ ਦਾ ਬਿੱਲ ਆਏਗਾ ਤਾਂ ਕਿਤੇ ਨਾ ਕਿਤੇ ਜਿਹੜੇ ਲੋਕ ਨੇ ਉਹ ਸਾਵਧਾਨ ਹੋਣਗੇ ਇਸ ਨੂੰ ਲੈ ਕੇ ਹਾਂ ਮੈਨੂੰ ਲੱਗਦਾ ਵੀ ਜਿਹੜੇ ਜਿਹਨਾਂ ਕੋਲ ਬਹੁਤ ਪੈਸਾ ਹੈਗਾ ਸ਼ਾਇਦ ਉਹਨਾਂ ਨੂੰ ਕੋਈ ਫ਼ਰਕ ਨਾ ਵੀ ਪਵੇ ਪਰ ਮੈਨੂੰ ਲੱਗਦਾ ਇਹਦੇ ਨਾਲ ਬਹੁਤ ਜ਼ਿਆਦਾ ਪਾਣੀ ਸੇਵ ਕਰਨ ਵਿੱਚ ਹੈਲਪ ਮਿਲ ਸਕਦੀ ਹੈ ਬਾਕੀ ਮੇਰੇ ਪਰਸਨਲ ਓਪੀਨੀਅਨਸ ਨੇ ਮੈਂ ਗਲਤ ਵੀ ਹੋ ਸਕਦੀ ਹਾਂ ਜਿੰਨੀ ਮੈਨੂੰ ਹੁਣ ਤੱਕ ਨੌਲੇਜ ਮਿਲੀ ਆ ਉਸ ਦੇ ਅਕੋਰਡਿੰਗ ਮੈਂ ਇਹ ਵਿਊਜ਼ ਜਿਹੜੇ ਨੇ ਪ੍ਰਜੈਂਟ ਪ੍ਰਜ਼ੈਂਟ ਕੀਤੇ ਨੇ